ਪੰਜਾਬ ਵਿਚ ਕਾਰੋਬਾਰ ਲਈ ਇੱਥੇ ਐਗਰੀਕਲਚਰ ਬਹੁਤ ਵੱਡਾ ਮੁੱਖ ਖੇਤਰ ਹੈ ਜਿਸ ਵਿੱਚ ਸਾਡੇ ਪੰਜਾਬ ਦੇ ਲੋਕ ਐਗਰੀਕਲਚਰਿੰਗ ਕਰਦੇ ਹਨ ਜਿੱਦਾਂ ਔਰਗੈਨਿਕ ਐਗਰੀਕਲਚਰਿੰਗ ਇਜ ਸਾਡੇ ਦੇ ਪੰਜਾਬ ਵਿੱਚ ਬਹੁਤ ਜ਼ਿਆਦਾ ਹੀ ਮੁੱਖ ਤੌਰ 'ਤੇ ਵੀ ਯੂਸ ਹੁੰਦੀ ਹੈ ਜੀ ਸਾਡੇ ਪੰਜਾਬ ਤੋਂ ਹੀ ਪੂਰੇ ਵਡ ਇੰਡੀਆ ਦੇ ਜ਼ਿਆਦਾ ਨਾਈਟੀ ਏਟੀ ਪ੍ਰਸੈਂਟ ਉਹ ਵੀਟ ਰਾਈਸ ਸਾਡੇ ਪੰਜਾਬ ਤੋਂ ਹੀ ਐਕਸਪੋਰਟ ਕੀਤਾ ਜਾਂਦਾ ਹੈ ਇਸ ਇਸ ਇਸੀ ਇਹ ਹੀ ਖੇਤਰ ਵਿੱਚ ਸਾਡੇ ਪੰਜਾਬ ਵਿੱਚ ਬਹੁਤ ਜ਼ਿਆਦਾ ਮੁੱਖ ਕਾਰੋਬਾਰ ਹੈ ਅਤੇ ਸਾਡਾ ਦੂਜਾ ਇੱਥੇ ਦੇ ਪ੍ਰੋਸੈਸ ਪ੍ਰੋਸੈਸਿੰਗ ਕਰਨਾ ਵੀ ਸਾਡੇ ਇੱਥੇ ਦਾ ਬਹੁਤ ਵੱਡਾ ਕਾਰਨ ਹੈ ਹੀ ਜਿਹੜੀ ਪੈਕਿੰਗ ਕਰ ਕਰਕੇ ਔਰਗੈਨਿਕ ਖੇਤੀ ਵੈਜੀਟੇਬਲਸ ਦੀ ਵੀ ਇਹਨਾਂ ਨੂੰ ਬ੍ਰਾਂਡਿੰਗ ਦੇ ਕੇ ਇਹਨਾਂ ਨੂੰ ਅੱਗੇ ਬਹੁਤ ਜ਼ਿਆਦਾ ਅੱਗੇ ਭੇਜਿਆ ਜਾ ਸਕਦਾ ਐਕਸਪੋਟ ਇੰਪੋਰਟ ਕੀਤਾ ਜਾ ਸਕਦਾ ਹੈ ਇਹ ਹੀ ਸਾਡੀ ਇਹ ਵੀ ਸਾਡੇ ਪੰਜਾਬ ਵਿੱਚ ਬਹੁਤ ਜ਼ਿਆਦਾ ਵੱਡੇ ਤੌਰ 'ਤੇ ਕੀਤਾ ਜਾਂਦਾ ਹੈ ਸਾਡੇ ਦੇਸ਼ ਪੰਜਾਬ ਵਿੱਚ ਰਿਕੁਆਇਰਮੈਂਟ ਏਜੰਸੀਆਂ ਵੀ ਬਹੁਤ ਜ਼ਿਆਦਾ ਹਨ ਜਿਹਨਾਂ ਨਾਲ ਇਹ ਕਹੇ ਸਾਡੇ ਬੰਦਿਆਂ ਨੂੰ ਅੱਗੇ ਭੇਜਦੇ ਹਨ ਕ ਕੰਮ ਕਰਨ ਲਈ ਇਹ ਵੀ ਸਾਡੇ ਪੰਜਾਬ ਵਿਚ ਕਾਰੋਬਾਰਾਂ ਲਈ ਬਹੁਤ ਮੁੱਖ ਮੌਕੇ ਹਨ ਸਾਡੇ ਪੰਜਾਬ ਵਿੱਚ ਬਹੁਤ ਜ਼ਿਆਦਾ ਟੈਕਸਟਾਈਸ ਦੇ ਵੀ ਕੰਮ ਹਨ ਹੈਡਲੂਮ ਟੈਕਸ ਹੈ ਜਿੱਦਾਂ ਸਾਡੇ ਪੰਜਾਬ ਵਿੱਚ ਪ੍ਰੋਸੈਸਿੰਗ ਐਗਰੀਕਲਚਰ ਇਜ ਵੈਰੀ ਬਹੁਤ ਜ਼ਿਆਦਾ ਹੀ ਜ਼ਿਆਦਾ ਕੰਮ ਐਗਰੀਕਲਚਰ ਪ੍ਰੋਸੈਸਿੰਗ ਦਾ ਇਹ ਹੀ ਔਰਗੈਨਿਕ ਪ੍ਰੋਸੈਸਿੰਗ ਦਾ ਇਹ ਹੀ ਹੈ ਜਿਸ ਵਿੱਚ ਔਰਗੈਨਿਕ ਐਗਰੀਕਲਚਰ ਕਰਦੇ ਹਨ ਸਾਡੀ ਔਰਗੈਨਿਕ ਐਗਰੀਕਲਚਰ ਜੋ ਵੀ ਹਨ ਉਹ ਹੀ ਬ੍ਰਾਂਡਿੰਗ ਨੂੰ ਬਣਾ ਕੇ ਉਹਨਾਂ ਨੂੰ ਪ੍ਰੋਸੈਸ ਕਰਦੇ ਹਨ ਉਹਦੇ ਬਾਅਦ ਉਹਨਾਂ ਨੂੰ ਬਰੈਂਡਿੰਗ ਕਰਦੇ ਹਨ ਉਹਨਾਂ ਨੂੰ ਫਿਰ ਉਹ ਤੋਂ ਬਾਅਦ ਬਹੁਤ ਵੱਡੇ ਤੌਰ 'ਤੇ ਐਕਸਪੋਰਟ ਕੀਤਾ ਜਾਂਦਾ ਹੈ ਜਿਸ ਵਿੱਚ ਸਾਡੇ ਪੰਜਾਬ ਨੂੰ ਬਹੁਤ ਜ਼ਿਆਦਾ ਸ ਇਹ ਇੱਕ ਤਰ੍ਹਾਂ ਦਾ ਬਹੁਤ ਜ਼ਿਆਦਾ ਸਪੋਰਟ ਮਿਲਦਾ ਹੈ ਅਤੇ ਇਸ ਨਾਲ ਸਾਡੇ ਕਾਰੋਬਾਰ ਵਿੱਚ ਬਹੁਤ ਜ਼ਿਆਦਾ ਮੁੱਖ ਸਾਡੇ ਭੂਮਿਕਾ ਨਿਭਾਉਂਦੇ ਹਨ ਸਾਡੇ ਪੰਜਾਬ ਵਿੱਚ ਇਹ ਮੁੱਖ ਮੌਕੇ 'ਤੇ ਵਰ ਚੂਸ 'ਤੇ ਵਰਤੇ ਜਾਂਦੇ ਹਨ